ਹੈਲੋ ਹਾਂ ਕਿ ਕਿੱਥੇ ਨੇ ਅਤੇ ਕਣਕ ਕੁਣਕ ਪੱਕ ਗਈ ਤੇਰੀ ਕਿ ਨਹੀਂ ਅਜੇ ਸਾਡੀ ਤਾਂ ਬਹੁਤ ਵਧੀਆ ਐਤਕੀਂ ਅਸੀਂ ਤਾਂ ਖਾਦ ਖੁਦ ਨਹੀਂ ਪਾਈ ਹੈਗੀ ਅਸੀਂ ਤਾਂ ਰੂੜੀ ਪਾਈ ਦੇਸੀ ਅਤੇ ਉਹਦੇ ਨਾਲ ਕਣਕ ਤਾਂ ਬਹੁਤ ਵਧੀਆ ਪਰ ਝਾੜ ਥੋੜ੍ਹਾ ਘੱਟ ਨਿਕਲੇਗਾ ਪਰ ਖਾਣ ਵਾਸਤੇ ਬਹੁਤ ਵਧੀਆ ਹੋਏਗੀ ਸਾਡੀ ਤੁਸੀਂ ਅਸੀਂ ਕਿੱਲੇ 'ਚ ਰੂੜੀ ਇੱਕ ਟਰਾਲੀ ਹਾਂ ਹਾਂ ਸਾਡੀ ਕਣਕ ਤਾਂ ਬਹੁਤ ਵਧੀਆ ਮੋਟੀ ਮੋਟੀ ਹੋਰ ਹਾਂ ਕਿੰਨੀ ਕਿੰਨੀ ਖਾਦ ਪਾਈ ਤੁਸੀਂ ਇੰਨੀ ਜ਼ਿਆਦਾ ਹਾਂ ਅੱਛਾ ਅੱਛਾ ਅਸੀਂ ਤਾਂ ਕੋਈ ਨਹੀਂ ਪਾਈ ਨਾ ਅਸੀਂ ਸਪਰੇਅ ਵੀ ਕੋਈ ਨਹੀਂ ਕੀਤੀ ਐਤਕੀਂ ਕੋਈ ਵੀ

ਅਤੇ ਹੁਣ ਕਣਕ ਵੱਢਣ ਦਾ ਟਾਈਮ ਆ ਗਿਆ ਤਾਂ ਹੁਣ ਬੰਦੇ ਬੁੰਦੇ ਲੱਭ ਜਾਣਗੇ ਅੱਛਾ ਫਿਰ ਸਾਡੇ ਵੱਲ ਵੀ ਘੱਲਦੀ ਸਾਡੇ ਵੱਲ ਵੀ ਘੱਲਦੀ ਸਾਡੇ ਵੱਲ ਇੱਧਰ ਕੋਈ ਨਹੀਂ ਹੈਗੇ ਬੰਦੇ ਬੁੰਦੇ ਕੋਈ ਖ਼ਾਸ ਲੱਭਦੇ ਦੋ ਤਿੰਨ ਬੰਦੇ ਚਾਹੀਦੇ ਨੇ

ਅਤੇ ਹੋਰ ਉਹਨਾਂ ਦੇ ਨਾਲ ਕਰ ਲਈ ਗੱਲ ਗੁੱਲ ਦਿਹਾੜੀ ਦਿਓੜੀ ਬਸ ਆ ਵਿਸਾਖੀ ਤੋਂ ਬਾਅਦ ਵੱਡਾਂਗੇ

ਹੋਰ ਫਿਰ ਹੋਰ ਕੀ ਕਰਦੇ ਹੁੰਦੇ ਹੋ ਅੱਛਾ ਤੁਸੀਂ ਕੰਪਾਇਨ ਨਾਲ ਵੱਡੋਗੇ ਅੱਛਾ ਫਿਰ ਤਾਂ ਵਧੀਆ ਸਾਡੇ ਝੱਟ ਸਾਂਭੀ ਜਾਏਗੀ ਸਾਨੂੰ ਫਿਰ ਟਾਈਮ ਲੱਗੇਗਾ ਬਹੁਤ ਅਸੀਂ ਤਾਂ ਦਿਹਾੜੀ 'ਤੇ ਵਡਾਵਾਂਗੇ ਨਾ ਫਿਰ ਸਾਡੀ ਕੰਬਾਇਨ ਵਾਲੀ ਕਣਕ ਨਹੀਂ ਨਾ ਸਾਡੀ ਕਣਕ ਦੂਜੀ ਹੈ ਨਾ ਅਸੀਂ ਖਾਦ ਦੇਸੀ ਖਾਦ ਵਾਲੀ ਖਾਣ ਵਾਸਤੇ ਹਾਂ ਖਾਣ ਵਾਸਤੇ ਹੀ ਬਣਾਉਣੀ ਹੈ ਅਸੀਂ ਤਾਂ

ਰੇਟ ਤਾਂ ਪਤਾ ਨਹੀਂ ਅਜੇ ਹੋਇਆ ਨਹੀਂ ਨਾ ਫਿਕਸ ਉਵੇਂ ਤਾਂ ਦੋ ਤਿੰਨ ਦੋ ਢਾਈ ਹਜ਼ਾਰ ਨੂੰ ਹੈਗੀ ਹੈ ਉਵੇਂ ਪਤਾ ਨਹੀਂ ਕੀ ਲੱਗੇਗਾ ਐਤਕੀਂ ਰੇਟ ਵਾਢੀਆਂ ਕਿੰਨੀ ਅਜੇ ਨਹੀਂ ਹੋਈਆਂ ਅਜੇ ਤਾਂ ਬਸ ਥੋੜ੍ਹੇ ਦਿਨ ਤੱਕ ਹੋਣ ਵਾਲੀਆਂ ਹੀ ਨੇ ਨਾ ਹਜੇ ਨਹੀਂ ਹੋਈਆਂ ਵਿ ਵਿਸਾਖੀ ਦੇ ਨੇੜੇ ਨੇੜੇ ਹਾਂ ਠੀਕ ਹੈ ਚਲੋ ਫਿਰ ਮਿਲਦੇ ਹਾਂ ਓਕੇ ਓਕੇ ਬਾਏ